ਮੈਂ ਅਚਾਰ ਬਣਾਉਣ ਦੀ ਪ੍ਰੀਖਿਆ ਨੂੰ ਵਿਆ ਦੀ ਵਿਆਖਿਆ ਕਰ ਸਕਦੀ ਹਾਂ ਕਿਉਂਕਿ ਅਚਾਰ ਬਣਾਉਣ ਲਈ ਸਾਨੂੰ ਕੱਚੇ ਅੰਬਾਂ ਦੀ ਲੋੜ ਪੈਂਦੀ ਹੈ ਅੰਬਾਂ ਨੂੰ ਧੋ ਧੋ ਕੇ ਉਨ੍ਹਾਂ ਦੀਆਂ ਫਾੜੀਆਂ ਕਰੋ ਅਤੇ ਫਿਰ ਉਨ੍ਹਾਂ ਨੂੰ ਧੁੱਪ ਲਗਾ ਦਿਓ ਇਸ ਤੋਂ ਬਾਅਦ ਉਨ੍ਹਾਂ ਨੂੰ ਬਣਾਉਣ ਲਈ ਮਸਾਲਿਆਂ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਹਲਦੀ ਨਮਕ ਦੀ ਲੋੜ ਪੈਂਦੀ ਹੈ ਫਿਰ ਅਚਾਰ ਨੂੰ ਬਣਾਉਣ ਲਈ ਉਨ੍ਹਾਂ ਦੀਆਂ ਫਾੜੀਆਂ ਕਰਕੇ ਉਨ੍ਹਾਂ ਨੂੰ ਧੁੱਪੇ ਸਕਾ ਦਿਓ ਉਸ ਵਿੱਚ ਫਿਰ ਹਲਦੀ ਨਮਕ ਅਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਪੈਂਦੀਆਂ ਹਨ ਜਿਹਨਾਂ ਜਿਨ੍ਹਾਂ ਨੂੰ ਪਾ ਕੇ ਇੱਕ ਬਰਤਨ ਵਿੱਚ ਰੱਖ ਦਿਓ ਫਿਰ ਉਸ ਬਰਤਨ ਨੂੰ ਦੋ ਦਿਨ ਧੁੱਪੇ ਸਕਾਓ ਅਤੇ ਫਿਰ ਸਾਡਾ ਅਚਾਰ ਤਿਆਰ ਹੋ ਜਾਂਦਾ ਹੈ ਵਿੱਚ ਫਿਰ ਅਸੀਂ ਸਾਡੇ ਪਾਪੜ ਹੋਰਾਂ ਰਾਜਾਂ ਰਾਜਾਂ ਦੇ ਪਾਪੜਾਂ ਨਾਲੋਂ ਇਸ ਕਰਕੇ ਸਵਾਦ ਹੁੰਦੇ ਹਨ ਸਵਾਦ ਹੁੰਦੇ ਹਨ ਕਿਉਂਕਿ ਇਹ ਚੋਲਾਂ ਦੇ ਆਟੇ ਦੇ ਬਣਾਏ ਜਾਂਦੇ ਹਨ ਅਤੇ ਇਹ ਬਹੁਤ ਹੀ ਵਧੀਆ ਹੁੰਦੇ ਹਨ ਥੈਂਕਿ ਊ